ਜੇ ਮੈਨੂੰ ਕਿਸੇ ਮਸ਼ਹੂਰ ਤਕਨੀਕੀ ਉਦਮੀ ਨਾਲ ਮੇਰਾ ਹੈਗਾ ਕਿ ਜੇ ਤਾਂ ਮੈਂ ਸਟੀਫ ਚੋਪ ਬਣ ਗਿਆ ਤੇ ਸਭ ਤੋਂ ਪਹਿਲਾਂ ਮੈਂ ਇੱਕ ਚੀਜ਼ ਕਰਾਂਗਾ ਜਿੱਦਾਂ ਕੀ ਤੁਸੀਂ ਦੇਖ ਕੇ ਸਕਦੇ ਹੋ ਅੱਜ ਕੱਲ ਐਪਲ ਮੈਂ ਕੋਸ ਦੀ ਕਿੰਨੀ ਜਿਆਦਾ ਡਿਮਾਂਡ ਹੈ ਮੈਂ ਕੀ ਕਰਾਂਗਾ ਕਿ ਮੈਂ ਹਰ ਕੋਲਜ ਜਾਂ ਸਕੂਲਾਂ ਦੇ ਵਿੱਚ ਘੱਟੋ ਘੱਟ ਨੀ ਤੇ ਦੋ ਚਾਰ ਜਾਂ ਪੰਜ ਮੈਕ ਪੀਸਿਸ ਦਵਾਂਗਾ ਜਿਹਦੇ ਨਾਲ ਕੀ ਹੋਏਗਾ ਕਿ ਜਿਹੜੇ ਬੱਚੇ ਹੈਗੇ ਨੇ ਉਹ ਮੈਕ ਵੱਧ ਤੋਂ ਵੱਧ ਯੂਜ ਕਰਨ ਜਿੱਦਾਂ ਕੀ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਜੇ ਆਪਾਂ ਵਿੰਡੋਜ ਦੀ ਗੱਲ ਕਰੀਏ ਵਿੰਡੋਜ਼ ਮਾਰਕੀਟ ਦੇ ਵਿੱਚ ਇਨਾ ਕਿਉਂ ਜਿਆਦਾ ਹੈ ਵਿੰਡੋ ਮਾਰਕੀਟ ਦੇ ਵਿੱਚ ਇਸ ਲਈ ਜਿਆਦਾ ਹੈ ਕਿਉਂਕਿ ਆਪਾਂ ਛੋਟੇ ਹੁੰਦੇ ਤੋਂ ਹੀ ਅਸੀਂ ਵਿੰਡੋਜ ਓਪਰੇ ਜਿਹੜੇ ਵਿੰਡੋਜ ਦੇ ਕੰਪਿਊਟਰ ਯੂਜ ਕਰਦੇ ਆ ਰਹੇ ਹੁਣ ਵਿੰਡੋ ਦੇ ਕੰਪਿਊਟਰ ਆਪਾਂ ਕਿਉਂ ਯੂਜ ਕਰਦੇ ਆ ਰਹੇ ਆ ਉਹਦਾ ਸਭ ਤੋਂ ਵੱਡਾ ਮੇਨ ਰੀਜ਼ਨ ਹੈ ਕਿ ਵਿੰਡੋਜ ਦੀ ਆਪਾਂ ਪਾਇਰੇਟਡ ਜਿਹੜਾ ਆਪਾਂ ਕਹਿ ਸਕਦੇ ਆ ਕਿ ਜੋ ਹੈ ਤਾਂ ਵੈਸੇ ਗਲਤ ਕਿ ਅਸੀਂ ਵਿੰਡੋ ਪਾਇਰੇਟਡ ਜਿਹੜੇ ਹੁੰਦੇ ਨੇ ਪੁਰਾਣੇ ਸਮੇਂ ਦੇ ਵਿੱਚ ਯੂਜ ਕਰਦੇ ਸੀ ਫਿਰ ਉਹਦੇ ਨਾਲ ਕੀ ਹੁੰਦਾ ਕਿ ਬੰਦੇ ਨੂੰ ਉਸ ਚੀਜ਼ ਦੀ ਲੱਤ ਲੱਗ ਜਾਂਦੀ ਹੈ ਕਿ ਹੁਣ ਜਿੱਦਾਂ ਕਿ ਬੱਚੇ ਬੱਚੇ ਨੂੰ ਵਿੰਡੋ ਸੈਂਪਲ ਚਲਾਣਾ ਆਉਂਦਾ ਬਟ ਹਰ ਬੱਚੇ ਨੂੰ ਮੈਕ ਓ ਐਸ ਚਲਾਣਾ ਨਹੀਂ ਆਉਂਦਾ ਬਿਕੋਜ਼ ਉਹਦਾ ਇਟ ਜਿਹੜਾ ਚਲਾਣ ਦਾ ਤਰੀਕਾ ਵੇ ਔਰ ਉਹ ਹੁਣ ਮੈਕ ਦਾ ਸਭ ਤੋਂ ਵੱਡਾ ਕੀ ਡਰੋ ਬੈਕ ਹੈਗਾ ਸਟੀਵ ਜੋਬ ਦੇ ਨਾਲ ਮੈਂ ਜੇਕਰ ਹਨਮੰਦ ਹੁੰਦਾ ਮੈਂ ਸਭ ਤੋਂ ਪਹਿਲਾਂ ਇਹਦੀ ਕੀਮਤਾਂ ਘੱਟ ਕਰਨੀਆਂ ਸੀ ਕੀਮਤਾਂ ਘੱਟ ਕਰਨ ਤੋਂ ਬਾਅਦ ਮੈਂ ਉਹਦੇ ਉੱਤੇ ਆਫਰਸ ਲਿਆਉਂਦਾ ਤੇ ਮੇਰਾ ਜਿਹੜਾ ਪ੍ਰਾਈਸ ਕੰਪੈਰਟਿਵਲੀ ਹੈ ਤੇ ਮੈਂ ਇਹਦਾ ਉਹਦੇ ਰਿਕਾਰਡਿੰਗ ਹੀ ਰੱਖਦਾ ਜਿਹੜੇ ਐਪਲ ਦੀ ਮੋਨੋਪੋਲੀ ਐ ਉਹਨੂੰ ਖਤਮ ਕਰਦਾ ਉਹਦੇ ਨਾਲ ਕੀ ਹੋਊਗਾ ਕਿ ਮਤਲਬ ਜਿਹੜਾ ਆਮ ਆਦਮੀ ਆ ਉਹ ਵੀ ਐਪਲ ਦਾ ਪ੍ਰੋਡਕਟ ਯੂਜ ਕਰ ਸਕੇ ਅੱਜ ਕੱਲ ਕੀ ਹੈ ਸਾਨੂੰ ਮਤਲਬ ਹੁਣ ਇਦਾਂ ਵਿੱਚ ਹੁੰਦਾ ਕਿ ਜੇ ਕਿਸੇ ਦੇ ਕੋਲ ਐਪਲ ਦਾ ਫੋਨ ਹ ਤੇ ਉਹਨੂੰ ਬਹੁਤ ਵੱਡਾ ਸਮਝਿਆ ਜਾਂਦਾ ਕਿ ਜਿਦਾਂ ਜੋ ਕਿ ਸਹੀ ਨਹੀਂ ਹ ਮੈਂ ਦੇਖਦਾ ਜਿਨਾਂ ਨੇ ਐਪਲ ਲਿੱਤੇ ਹੁੰਦੇ ਆ ਉਹ ਕਰਜਿਆਂ ਦੇ ਵਿੱਚ ਹੁੰਦੇ ਨੇ ਜਿਹਨਾਂ ਦੇ ਕੋਲ ਐਡਰਾਇਡ ਹੁੰਦੇ ਨੇ ਆਪਣੇ ਸੁਖੀ ਜੀਵਨ ਜੀਂਦੇ ਨੇ ਤੋ ਉਹ ਚੀਜ਼ ਮੈਨੂੰ ਖਤਮ ਕਰਕੇ ਉਹ ਇਸ ਚੀਜ਼ ਨੂੰ ਓਵਰਕਮ ਕਰਾਂਗਾ